ਮੈਂ ਜਿੱਥੇ ਰਹਿੰਦਾ ਹਾਂ ਉਸ ਖੇਤਰ ਦੇ ਵਿੱਚ ਜਨਤਕ ਖੇਡ ਸਿਖਲਾਈ ਕੇਂਦਰ ਹੈ ਉਸ ਕੇਂਦਰ ਦਾ ਨਾਮ ਹੈ ਨਹਿਰੂ ਸਟੇਡੀਅਮ ਉੱਥੇ ਰਹਿਣ ਵਾਲੇ ਲੋਕਾਂ ਲਈ ਹੀ ਉਹ ਉਪਲਬਧ ਹੈ ਉੱਥੇ ਲੋਕ ਜ਼ਿਆਦਾਤਰ ਆਪਣਾ ਭੱਜਦੇ ਦੌੜਦੇ ਹਨ ਖੇਡਦੇ ਕੁੱਦਦੇ ਹਨ ਸ਼ਾਮ ਨੂੰ ਬੱਚੇ ਸਕੂਲ ਤੋਂ ਆ ਕੇ ਕ੍ਰਿਕਟ ਵੀ ਖੇਡਦੇ ਹਨ ਹੁਣ ਜਿਵੇਂ ਕਿ ਗਰਮੀ ਦੀਆਂ ਛੁੱਟੀਆਂ ਚੱਲਦੀਆਂ ਹੈ ਹਨ ਅਤੇ ਉੱਥੇ ਬਹੁਤ ਸਾਰੇ ਬੱਚੇ ਪੜ੍ਹਨ ਅ ਖੇਡਣ ਆਉਂਦੇ ਹਨ ਅਤੇ ਖੇਡ ਕੇ ਕੁਝ ਸਿੱਖਦੇ ਵੀ ਹਨ ਅਤੇ ਉੱਥੇ ਟ੍ਰੇਨਰ ਵੀ ਮੌਜੂਦ ਹੁੰਦੇ ਹਨ ਜੋ ਕਿ ਫਿੱਟਨੈਸ ਦੇ ਉੱਤੇ ਭੱਜਣ ਦੌੜ ਦੇ ਉੱਤੇ ਜਿਹੜਾ ਹੈਗਾ ਖਾਸ ਧਿਆਨ ਦਿੰਦੇ ਹਨ ਅਤੇ ਬੱਚਿਆਂ ਨੂੰ ਵੀ ਉਹ ਮੋਟੀਵੇਟ ਕਰਦੇ ਹਨ ਕਿ ਤੁਸੀਂ ਇੱਥੇ ਆ ਕੇ ਆਪਣੀ ਸਿਹਤ ਦੇ ਉੱਤੇ ਤਵੱਜੋ ਦਿਉ ਤਾਂਕਿ ਤੁਸੀਂ ਆਪਣੀ ਸਿਹਤ ਪੱਖੀ ਤੰਦਰੁਸਤ ਅਤੇ ਅੱਛਾ ਜੀਵਨ ਆਪਣਾ ਰ ਕੱਢ ਸਕਦੇ ਹੋ ਅਤੇ ਉਹਨਾਂ ਦੀ ਵਰਤੋਂ ਆਮ ਤੌਰ 'ਤੇ ਲੋਕ ਵੀ ਕਰਦੇ ਹਨ ਅਤੇ ਬੱਚੇ ਬਜ਼ੁਰਗ ਵੀ ਕਰਦੇ ਹਨ ਬਜ਼ੁਰਗ ਸ਼ਾਮ ਨੂੰ ਆ ਕੇ ਉੱਥੇ ਤਾਜ਼ੀ ਹਵਾ ਦਾ ਆਨੰਦ ਮਾਣਦੇ ਹਨ ਅਤੇ ਕੁਝ ਬੱਚੇ ਆ ਕੇ ਉੱਥੇ ਪੜ੍ਹਦੇ ਹਨ ਕਿਉਂਕਿ ਉੱਥੇ ਦਾ ਵਾਤਾਵਰਣ ਬਹੁਤ ਹੀ ਸ਼ਾਂਤਮਈ ਹੈ ਅਤੇ ਉੱਥੇ ਰੌਲਾ ਰੱਪਾ ਬਹੁਤ ਹੀ ਘੱਟ ਪਾਇਆ ਜਾਂਦਾ ਹੈ ਅਤੇ ਉੱਥੇ ਹੋਰ ਵੀ ਜਿਹੜੀਆਂ ਪਾਣੀ ਦੀਆਂ ਸੇਵਾਵਾਂ ਹੋਰ ਹੋਰ ਵੀ ਸੇਵਾਵਾਂ ਮੌਜੂਦ ਹਨ ਅਤੇ ਉੱਥੇ ਨਿੱਘੀ ਛਾਂ ਵੀ ਹੈਗੀ ਦਰੱਖਤਾਂ ਦੀ ਜਿੱਥੇ ਕਿ ਬੈਠ ਕੇ ਧੁੱਪ ਦੇ ਵਿੱਚ ਆਨੰਦ ਮਾਣ ਸਕਦੇ ਹਨ ਸੋ ਉੱਥੇ ਹਰ ਇੱਕ ਚੀਜ਼ ਉਪ ਉਪਲਬਧ ਹੈ ਜਿੱਥੇ ਕਿ ਅ ਆਸ ਪਾਸ ਦੇ ਲੋਕ ਜਿਹੜਾ ਉੱਥੇੇ ਆਨੰਦ ਮਾਣ ਸਕਦੇ ਹਨ